ਜੀ ਸਤਿ ਸ਼੍ਰੀ ਅਕਾਲ ਜੀ ਜੇਕਰ ਆਪਾਂ ਗੱਲ ਕਰੀਏ ਖੇਡ ਸਟੇਡੀਅਮ ਦੀ ਸਾਡੇ ਪੰਜਾਬੀ ਵਿੱਚ ਬਹੁਤ ਹੀ ਜ਼ਿਆਦਾ ਖੇਡ ਸਟੇਡੀਅਮ ਹਨ ਜੇਕਰ ਮੈਂ ਕਰਾਂ ਆਪਣੇ ਜ਼ਿਲ੍ਹੇ ਦੀ ਗੱਲ ਕਰਦਾ ਤਾਂ ਸਾਡੇ ਸਟੇਡੀਅਮ ਜ਼ਿਲ੍ਹੇ ਵਿੱਚ ਦੋ ਸਟੇਟਸ ਅਤੇ ਇੰਟਰਨੈਸ਼ਨਲ ਖੇਡ ਸਟੇਡੀਅਮ ਹਨ ਇੱਕ ਕਿ ਜਿਹੜਾ ਮੋਹਾਲੀ ਅਤੇ ਦੂਜਾ ਜੋ ਕਿ ਤਿਊਡ ਉਹ ਬਣ ਰਿਹਾ ਹੈ